ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਔਰ ਹਰਿਆ ਭਰਿਆ ਸ ਸਾਫ਼ ਵਾਤਾਵਰਨ ਰੱਖਣ ਲਈ ਸਾਨੂੰ ਦਰਖਤ ਲਗਾਉਣੇ ਚਾਹੀਦੇ ਹਨ ਆਪਣੇ ਨੇੜੇ ਸਫ਼ਾਈ ਰੱਖਣੀ ਚਾਹੀਦੀ ਹੈ ਸਾਨੂੰ ਦੂਸਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਪੇੜ ਪੌਦੇ ਲਗਾਉਣੇ ਚਾਹੀਦੇ ਹਨ ਵਾਤਾਵਰਨ ਵਿੱਚ ਹਰਿਆਲੀ ਅਰਾਮਦਾਇਕ ਬਹੁਤ ਹੀ ਵਧੀਆ ਸੋਰਸ ਹੈ ਔਰ ਸਾਨੂੰ ਆਪਣੇ ਆਲੇ ਦੁਆਲੇ ਘਰਾਂ ਵਿੱਚ ਵੀ ਇੱਕ ਨਾ ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ ਹੈ ਜਿਹਦੇ ਕਰਕੇ ਹਵਾ ਸਾਫ਼ ਰਹਿੰਦੀ ਹੈ ਔਰ ਸਾਡੇ ਨੇੜੇ ਦੇ ਇਲਾਕੇ ਵਿੱਚ ਇੱਕ ਪਾਰਕ ਹੈ ਜਿੱਥੇ ਅਸੀਂ ਅਕਸਰ ਘੁੰਮਣ ਜਾਂਦੇ ਹਾਂ ਉੱਥੇ ਪੇੜ ਪੌਦੇ ਲੱਗੇ ਦੇਖ ਕੇ ਹਰਿਆਲੀ ਦੇਖ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਤਾਜ਼ੀ ਹਵਾ ਸਾਡੀ ਸਿਹਤ ਨੂੰ ਤੰਦਰੁਸਤ ਬਣਾਉਂਦੀ ਹੈ ਹਵਾ ਵਿੱਚ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਜੋ ਕਿ ਪੌਦਿਆਂ ਦੁਆਰਾ ਹੀ ਮੁਮਕਿਨ ਹੈ ਪੌਦੇ ਹਵਾ ਨੂੰ ਸਾਫ਼ ਰੱਖਦੇ ਹਨ ਅਤੇ ਸਾਡੀ ਸਿਹਤ ਵੀ ਉਹਦੇ ਕਰਕੇ ਵਧੀਆ ਹੁੰਦੀ ਹੈ ਔਰ ਹਰਿਆਲੀ ਭਰਿਆ ਵਾਤਾਵਰਨ ਸਭ ਨੂੰ ਵਧੀਆ ਲੱਗਦਾ ਹੈ ਇਸ ਕਰਕੇ ਸਾਨੂੰ ਪੌਦਿਆਂ ਉੱਤੇ ਜ਼ਿਆਦਾ ਜੋ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਹਰਿਆਲੀ ਵੱਲ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ ਉਹਦੇ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਸੀਂ ਅਗਰ ਪੌਦੇ ਲਗਾਉਂਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਪਾਲਣ ਪੋਸ਼ਣ ਵੀ ਕਰਨਾ ਜ਼ਰੂਰੀ ਹੈ ਸਾਨੂੰ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ ਉਨ੍ਹਾਂ ਦੇ ਨੇੜੇ ਤੇੜੇ ਵੀ ਸਾਨੂੰ ਗੰਦ ਨਹੀਂ ਪੈਣ ਦੇਣਾ ਚਾਹੀਦਾ ਜਿਨ੍ਹਾਂ ਕਰਕੇ ਕਿ ਉਨ੍ਹਾਂ ਦੇ ਫੱਲਣ ਫੁੱਲਣ ਵਿੱਚ ਕੋਈ ਰੁਕਾਵਟ ਨਾ ਆਏ ਕੋਈ ਦੁਰਪ੍ਰਭਾਵ ਆ ਪਏ ਉਨ੍ਹਾਂ ਦੇ ਉੱਪਰ ਜਿਨ੍ਹਾਂ ਕਰਕੇ ਕਿ ਸਾਡੀ ਸਾਰੇ ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਸ ਅੱਜ ਕੱਲ੍ਹ ਲੋਕ ਦਰਖਤ ਵੱਢ ਕੇ ਉੱਥੇ ਘਰ ਬਣਾ ਰਹੇ ਹਨ ਜਿਹਦੇ ਕਰਕੇ ਸਾਡਾ ਤਾਂ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਜੋ ਕਿ ਗਲਤ ਗੱਲ ਹੈ ਸਾਨੂੰ ਇਸ ਦੇ 'ਤੇ ਰਿਲੇਟਡ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ ਸਾਨੂੰ ਪੌਦੇ ਲਗਾਉਣੇ ਚਾਹੀਦੇ ਹਨ